ਹੈਲੋ ਹਾਂਜੀ ਭਾਅ ਜੀ ਕੀ ਹਾਲ ਚਾਲ ਹੈ ਭਾਅ ਜੀ ਅਕਾਲ ਢਾਬੇ ਤੋਂ ਬੋਲਦੇ ਪਏ ਭਾਅ ਜੀ ਮੈਂ ਕਿਹਾ ਭਾਅ ਜੀ ਅੱਜ ਘਰ ਘਰਦੇ ਹੈ ਨਹੀਂ ਆ ਅਤੇ ਮੈਂ ਕਿਹਾ ਚਲੋ ਤੁਹਾਡੇ ਕੋਲੋਂ ਖਾਣਾ ਮੰਗਵਾਇਆ ਜਾਵੇ ਤੁਹਾਨੂੰ ਤੁਹਾਡੀ ਤਰੀਫ ਮੈਂ ਬਹੁਤ ਸੁਣੀ ਹੈ ਵੀ ਤੁਸੀਂ ਸਾਫ਼ ਸੁਥਰਾ ਖਾਣਾ ਬਣਾਉਂਦੇ ਹੈ ਵਧੀਆ ਬਣਾਉਂਦੇ ਆ ਅਤੇ ਮੈਂ ਕਿਹਾ ਭਾਅ ਜੀ ਥੋੜ੍ਹਾ ਜਿਹਾ ਓਡਰ ਲਿਖਿਓ ਭਾਅ ਜੀ ਇੱਕ ਪਲੇਟ ਦਾਲ ਪਾ ਦਿਓ ਭਾਅ ਜੀ ਇੱਕ ਪਲੇਟ ਮਟਰ ਪਨੀਰ ਪਾ ਦਿਓ ਅਤੇ ਹਾਫ ਮਿਕਸ ਵੈੱਜ ਪਾ ਦਿਓ ਅਤੇ ਤੀਹ ਰੁਪਏ ਦਾ ਰਾਇਤਾ ਪਾ ਦਿਓ ਅਤੇ ਨਾਲ ਅੱਠ ਤੰਦੂਰੀ ਫੁਲਕੇ ਪਾ ਦਿਓ ਅਤੇ ਭਾਅ ਜੀ ਇੱਕ ਗੱਲ ਹੈ ਭਾਅ ਜੀ ਮਿਰਚ ਮਸਾਲਾ ਬਹੁਤ ਘੱਟ ਰੱਖਿਓ ਅਤੇ ਦਾ ਨਮਕ ਨੁਮਕ ਵੀ ਬਹੁਤ ਘੱਟ ਰੱਖਿਓ ਕਿਉਂਕਿ ਘਰਦੇ ਨਾ ਨਾ ਜ਼ਿਆਦਾ ਘਰਦੇ ਖਾਂਦੇ ਆ ਅਤੇ ਨਾ ਹੀ ਖਾਂਦੇ ਜਿੰਨਾ ਜ਼ਿਆਦਾ ਅਤੇ ਨਾਲ ਭਾਅ ਜੀ ਮੈਂ ਕਿਹਾ ਭਾਅ ਜੀ ਮੇਰੇ ਤੋਂ ਆਇਆ ਨਹੀਂ ਜਾਣਾ ਭਾਅ ਜੀ ਇੱਕ ਤੁਸੀਂ ਮੈਨੂੰ ਘਰ ਦੇ ਬਾਹਰ ਪਹੁੰਚਾ ਦਿਓ ਮੇਰਾ ਡਰੈਸ ਡਰੁ ਲਿਖ ਲਓ ਭਾਅ ਜੀ ਵੋਲਟਮ ਦੋ ਸੌ ਪਚਾਸੀ ਕੋਠੀ ਨੰਬਰ ਅਤੇ ਆ ਕੇ ਭਾਅ ਜੀ ਮੈਨੂੰ ਫੋਨ ਫੁਨ ਕਰ ਦੀ ਫੋਨ ਕਰ ਦਿਓ ਅਤੇ ਮੈਂ ਤੁਹਾਡੇ ਕੋਲੋਂ ਓਡਰ ਲੈ ਲੂ ਤੁਹਾਡੇ ਕੋਲੋਂ ਆਪਣਾ ਓਡਰ ਲੈ ਲਊਗਾ ਅਤੇ ਨਾਲ ਹੀ ਤੁਹਾਨੂੰ ਪੇਮੈਂਟ ਕਰ ਦਊਂਗਾ ਅਤੇ ਭਾਅ ਜੀ ਤੁਹਾਡਾ ਮੈਂ ਨਾਲੇ ਬਹੁਤ ਸੁਣਿਆ ਵਾ ਸ਼ਹਿਰ 'ਚ ਨਾਂ ਵੀ ਸੁਣਿਆ ਵਾ ਤੁਹਾਡਾ ਸਾਫ਼ ਸੁਥਰਾ ਖਾਣਾ ਬਣਾਉਂਦੇ ਤੁਸੀਂ ਵਧੀਆ ਸੁਆਦਿਸ਼ਟ ਬਣਾਉਂਦੇ ਆ ਅਤੇ ਨਾਲੇ ਭਾਅ ਜੀ ਇਹ ਮੈਨੂੰ ਇਹ ਸੁਆਦਿਸ਼ਟ ਖਾਣਾ ਦਿਓ ਨਾਲੇ ਭਾਅ ਜੀ ਤੁਹਾਨੂੰ ਫਿਰ ਅਗਾਂਹ ਤੋਂ ਅਸੀਂ ਓਡਰ ਲਖਾਵਾਂਗੇ ਸਾਡੇ ਹੋਰ ਫ਼ੰਕਸ਼ਨਸ ਹੋਣੇ ਆ ਹੋਰ ਓਡਰ ਲਿਖਾਵਾਂਗੇ ਵੱਧ ਤੋਂ ਵੱਧ ਧੰਨਵਾਦ